ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਕੀ ਕੀ ਦਿੱਕਤ ਆ

ਕੀ ਦਿੱਕਤ ਆ ਸਰ ਤੁਹਾਡੀ ਅਤੇ ਸੜਕਾਂ ਤਾਂ ਪੂਰੀਆਂ ਸਾਫ਼ ਵਧੀਆ ਲਾਈਟਾਂ ਲੱਗੀ ਆ ਲੱਗੀਆਂ ਜੀ ਖ਼ਰਾਬ ਹੋ ਸਕਦੀਆਂ ਖ਼ਰਾਬ ਹੋ ਸਕਦੀ ਹੈ ਪਰ ਲੱਗੇ ਤਾ ਨਾ ਉਹ ਅਸੀਂ ਦੇਖ ਲਾ ਉਹ ਕੋਈ ਨਹੀਂ ਸਰ ਠੀਕ ਕਰਵਾ ਦੇਵਾਂਗੇ

ਹਾਂਜੀ ਉਹ ਅਸੀਂ ਹਲ ਠੀਕ ਕਰ ਕਰਵਾ ਵਾਂਗੇ ਜ਼ਰੂਰ ਹਾਂਜੀ ਉਸ ਦੀ ਵੀ ਮੁਰੰਮਤ ਜਲਦ ਤੋ ਜਲਦ ਕਰਾਵਾਂਗੇ ਖਾਲੇ ਉਹ ਹਾਂਜੀ ਤੁਹਾਡੀ ਕੋਈ ਨਹੀਂ ਤੁਹਾਡੀ ਮੁਸ਼ਕਿਲਾਂ ਦਾ ਹੱਲ ਜ਼ਰੂਰ ਕੱਢਾਗੇ ਹਾਂਜੀ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਹਾਂਜੀ ਠੀਕ ਠੀਕ ਹੈ ਅਸੀਂ ਅਸੀਂ ਜ ਜ਼ਰੂਰ ਹੱਲ ਕਰਾਂਗੇ ਜ਼ਰੂਰ ਆਵਾਂਗੇ ਅਤੇ ਹੱਲ ਕਰਕੇ ਜਾਊਂਗੇ ਜੀ ਧੰਨਵਾਦ